ਪੰਜਾਬ ਦੇ ਖੇਤੀਬਾੜੀ ਸੈਕਟਰ ਦਾ ਜਿਹੜਾ ਦੂਜੇ ਸੈਕਟਰਾਂ ਨਾਲ ਤਾਲ ਮੇਲ ਇਸ ਤਰ੍ਹਾਂ ਕਿ ਖੇਤੀਬਾੜੀ ਦੇ ਵਿੱਚ ਜਿਹੜੀ ਝੋਨਾ ਬੀਜਿਆ ਜਾਂਦਾ ਉਹਦਾ ਜਿਹੜਾ ਵੇਸਟਜ਼ ਜਿਹਨੂੰ ਕਿ ਪਰਾਲੀ ਕਿਹਾ ਜਾਂਦਾ ਉਹ ਪਰਾਲੀ ਤੋਂ ਪੈਟਰੋਲ ਵਗੈਰਾ ਵੀ ਅੱਜ ਕੱਲ੍ਹ ਪੈਦਾ ਕੀਤਾ ਜਾਂਦਾ ਇਹ ਉ ਉਹਦਾ ਵੀ ਸਹਿਯੋਗ ਹੁੰਦਾ ਦੂਜੇ ਸੈਕਟਰਾਂ ਨਾਲ ਹੋਰ ਖੇਤੀਬਾੜੀ ਤੋਂ ਨਾਲ ਜੇ ਅਸੀਂ ਦੇਖੀਏ ਕਿ ਆਪਾਂ ਮੱਝਾਂ ਘਰਾਂ ਦੇ ਵਿੱਚ ਪਾਲੀਆਂ ਜਾਂਦੀਆਂ ਨੇ ਜਿਹੜੀ ਜਿਨ੍ਹਾਂ ਦਾ ਕਿ ਗੁਜ਼ਾਰਾ ਖੇਤੀਬਾੜੀ ਤੋਂ ਹੁੰਦਾ ਹੈ ਉਹਦੇ ਬਦਲੇ ਸਾਨੂੰ ਉਹ ਦੁੱਧ ਦਿੰਦੀਆਂ ਨੇ ਦੁੱਧ ਦੇ ਨਾਲ ਦੁੱਧ ਤੋਂ ਅਗਾਂਹ ਫਿਰ ਇਹ ਕਈ ਪ੍ਰੋਡਕਟ ਬਣਾਏ ਜਾਂਦੇ ਹਨ ਜਿਵੇਂ ਕਿ ਮਿਲਕ ਦੁੱਧ ਦਾ ਪਾਊਡਰ ਬਣਾਇਆ ਜਾਂਦਾ ਹੈ ਦੁੱਧ ਤੋਂ ਮੱਖਣ ਬਣਾਇਆ ਜਾਂਦਾ ਹੈ ਮਕ ਹੋਰ ਕਈ ਤਰ੍ਹਾਂ ਦੀਆਂ ਇਹ ਚੀਜ਼ਾਂ ਜਿਹੜੀਆਂ ਤਿਆਰ ਕਰਕੇ ਅਤੇ ਉਹ ਦੂਸਰੇ ਉਦਯੋਗਾਂ ਦੇ ਵਿੱਚ ਵੀ ਉਹਨਾਂ ਦਾ ਸਹਿਯੋਗ ਹੁੰਦਾ ਹੈ ਬਾਕੀ ਜਿਹੜੀ ਇਸ 'ਤੇ ਪੰਜਾਬ ਦੇ ਵਿੱਚ ਜ਼ਿਆਦਾ ਖੇਤੀ ਕੀਤੀ ਜਾਣ ਵਾਲੀ ਫਸਲ ਜਿਹੜੀ ਆ ਉਹ ਕਣਕ ਹੈਗੀ ਆ ਕਣਕ ਦੀ ਪੈਦਾਵਾਰ ਜਿਹੜੀ ਆ ਇੱਥੇ ਪੰਜਾਬ ਦੇ ਵਿੱਚ ਕਾਫ਼ੀ ਚੰਗੀ ਹੁੰਦੀ ਹੈ